ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਹਾਂਜੀ ਬੋਲੋ ਅੱਛਾ ਜੀ ਅੱਛਾ ਅੱਛਾ ਅੱਛਾ ਕੋਈ ਗੱਲ ਨਹੀਂ ਇੱਥੇ ਨਾ ਆਪਣਾ ਲਾਗੇ ਆਪਣੇ ਰਣਜੀਤ ਐਵੇਨਿਊ ਵਿੱਚ ਹੀ ਡੀ ਟੀ ਓ ਦਫ਼ਤਰ ਹੈਗਾ ਜੇ ਉੱਥੇ ਤੁਸੀਂ ਚਲੇ ਜਾਓ ਉੱਥੇ ਬਾਹਰ ਹੀ ਬੈਠੇ ਹੁੰਦੇ ਨੇ ਉਹ ਫਾਰਮ ਭਰ ਦੇਣਗੇ ਉਹ ਨਾਲ ਹੀ ਉਹਨਾਂ ਨੇ ਸਾਰਾ ਤੁਹਾਡਾ ਨੰਬਰ ਚੇਂਜ ਕਰਵਾ ਦੇਣਾ ਹੈਗਾ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਬਹੁਤੀ ਗੱਲ ਆ ਸਵੇਰੇ ਮੇਰੇ ਨਾਲ ਚੱਲਿਓ ਅਤੇ ਆਪਾਂ ਗੱਡੀ ਦੇ ਵਿੱਚ ਚਲ ਜਾਂਗੇ ਅਤੇ ਕਰਾ ਆਵਾਂਗੇ ਉੱਥੇ ਕੀ ਹੈ ਠੀਕ ਹੈ ਜੀ ਹਾਜੀ ਠੀਕ ਹੈ ਜੀ ਮਿਹਰਬਾਨੀ